ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਪਾਣੀ ਨੂੰ ਫਿਲਟਰ ਕਰਨ ਦੇ ਅਤੇ ਸ਼ੁੱਧ ਕਰਨ ਦੇ ਕਾਫ਼ੀ ਸਾਰੇ ਕਾਫ਼ੀ ਸਾਰੀਆਂ ਕਾਫ਼ੀ ਸਾਰੇ ਤਰੀਕੇ ਤੁਹਾਨੂੰ ਮਿਲ ਜਾਣਗੇ ਉਹਦੇ ਵੀ ਸਭ ਤੋਂ ਇੰਪੋਰਟੈਂਟ ਅਤੇ ਸਭ ਤੋਂ ਜ਼ਰੂਰੀ ਜੋ ਤਰੀਕਾ ਹੈ ਉਹ ਹੈ ਪਾਣੀ ਨੂੰ ਉਬਾਲਣਾ ਜੋ ਕਿ ਸਭ ਤੋ ਸਾਫ਼ ਅਤੇ ਸਭ ਤੋਂ ਸਿਹਤਮੰਦ ਤਰੀਕਾ ਮੰਨਿਆ ਜਾਂਦਾ ਹੈ ਪਾਣੀ ਨੂੰ ਉਬਾਲਣ ਦੇ ਨਾਲ ਜੋ ਵੀ ਉਸਦੇ ਵਿੱਚ ਕਿਟਾਣੂ ਹੁੰਦੇ ਹਨ ਜਾਂ ਕਿਸੇ ਤਰ੍ਹਾਂ ਦਾ ਕੋਈ ਬੈਕਟੀਰੀਆ ਹੈ ਉਹ ਸਾਰੇ ਤਬਾਹ ਹੋ ਜਾਂਦੇ ਨੇ ਅਤੇ ਇੱਕ ਕੇਸ ਦੇ ਵਿੱਚ ਹੋਰ ਕਿਸੇ ਤਰ੍ਹਾਂ ਦੇ ਕਿਸੇ ਕੈਮੀਕਲ ਦੀ ਲੋੜ ਨਹੀਂ ਪੈਂਦੀ ਜਿਹਦੇ ਕਰਕੇ ਸਾਡੀ ਸਿਹਤ ਦੇ ਉੱਪਰ ਵੀ ਕਿਸੇ ਤਰ੍ਹਾਂ ਦੇ ਰਸਾਇਣ ਦਾ ਅਤੇ ਕਿਸੇ ਕੈਮੀਕਲ ਦਾ ਜ਼ਿਆਦਾ ਪ੍ਰਭਾਵ ਗਲਤ ਪ੍ਰਭਾਵ ਨਹੀਂ ਪੈਂਦਾ ਸਾਡੀ ਸਿਹਤ ਇਸਦੇ ਕਰਕੇ ਖ਼ਰਾਬ ਨਹੀਂ ਹੁੰਦੀ

ਦੇਖਿਆ ਜਾਵੇ ਤਾਂ ਸਭ ਤੋਂ ਜ਼ਿਆਦਾ ਵਧੀਆ ਅਤੇ ਸਭ ਤੋਂ ਟਿਕਾਊ ਘਰੇਲੂ ਇਲਾਜ ਪਾਣੀ ਨੂੰ ਉਬਾਲ ਕੇ ਪੀਓ ਧਿਆਨ ਰੱਖੋ ਕਿ ਪਾਣੀ ਰੱਖਣ ਦੀ ਜਗ੍ਹਾ ਸਾਫ਼ ਸੁਥਰੀ ਹੋਵੇ ਕੋਈ ਕਿਸੇ ਤਰ੍ਹਾਂ ਦੀ ਗੰਦਗੀ ਨਾ ਹੋਵੇ ਪਾਣੀ ਜੋ ਵੀ ਹੈ ਉਸਨੂੰ ਢੱਕ ਕੇ ਰੱਖੋ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਕੀਟਾਣੂ ਜਾਂ ਕਿਸੇ ਤਰ੍ਹਾਂ ਦਾ ਕੋਈ ਕੀੜਾ ਮਕੌੜਾ ਉਹਦੇ ਵਿੱਚ ਨਾ ਡਿੱਗੇ ਜਿਹਦੇ ਕਰਕੇ ਜੋ ਤੁਹਾਡਾ ਪਾਣੀ ਹੈ ਸਾਫ਼ ਸੁਥਰਾ ਰਹੇ ਉਸਦੇ ਕਰਕੇ ਉਸਨੂੰ ਪੀਣ 'ਤੇ ਤੁਹਾਨੂੰ ਬਾਅਦ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਸਿਹਤ ਦੀ ਸਮੱਸਿਆ ਨਾ ਪੈਦਾ ਹੋਵੇ